ਹਾਂਜੀ ਇੱਕ ਤਾਂ ਇਹ ਹੈ ਕਿ ਪਿੰਡਾਂ ਦੇ ਵਿੱਚ ਮਤਲਬ ਜਿਹੜੇ ਹੈਗੇ ਨੇ ਉਹ ਇਤਿਹਾਸਿਕ ਗੁਰਦੁਆਰੇ ਹੈਗੇ ਆ ਜਿਹੜੇ ਕਿਉਂਕਿ ਗੁਰੂ ਸਾਹਿਬਾਨ ਨੇ ਜਿਹੜੇ ਜਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੇ ਨਾਇਕ ਨੇ ਕਰੈਕਟਰਸ ਨੇ ਜਿਹੜੇ ਉਨ੍ਹਾਂ ਦਾ ਜੀਵਨ ਜ਼ਿਆਦਾ ਸ਼ਹਿਰ ਬਾਅਦ ਚੋਂ ਡਵੈੱਲਪ ਹੋਏ ਆ ਪਹਿਲਾਂ ਉਹ ਪਿੰਡਾਂ ਦੇ ਵਿੱਚ ਹੀ ਉਨ੍ਹਾਂ ਦਾ ਸਫ਼ਰ ਰਿਹਾ ਵੱਸਦੇ ਵੱਸਦੇ ਰਹੇ ਆ ਵਿਚਰਦੇ ਰਹੇ ਆ ਤਾਂ ਉੱਥੇ ਉਹ ਜਿਹੜੇ ਉਨ੍ਹਾਂ ਨਾਲ ਸੰਬੰਧਿਤ ਸਿੱਖ ਇਤਿਹਾਸ ਨਾਲ ਜਾਂ ਹੋਰ ਇਤਿਹਾਸ ਨਾਲ ਸੰਬੰਧਿਤ ਜਿਹੜੇ ਗੁਰੂ ਘਰ ਹੈਗੇ ਨੇ ਉਨ੍ਹਾਂ ਦੀ ਉਸਾਰੀ ਜਿਹੜੀ ਇਤਿਹਾਸਿਕ ਨਜ਼ਰੀਆ ਤੋਂ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਜਿਹੜੇ ਹੈਗੇ ਨੇ ਉੱਥੇ ਧਾਰਮਿਕ ਯਾਤਰਾ ਦੇ ਲਈ ਜਾਣਗੇ ਅਤੇ ਸੈਰ ਸਪਾਟਾ ਜਿਹੜਾ ਹੈਗਾ ਇੱਕ ਤਾਂ ਧਾਰਮਿਕ ਯਾਤਰਾ ਜਿਹੜੀ ਹੈਗੀ ਆ ਉਹ ਵਿਕਸਿਤ ਹੋਏਗੀ ਅਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਨਾ ਉਹ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਔਰਗੈਨਿਕ ਫਾਰਮ ਨੇ ਜਿਹੜੇ ਉਹ ਬਣਾਏ ਜਾ ਸਕਦੇ ਜਿਹਦੇ ਵਿੱਚ ਮੇਰੇ ਮੇਰਾ ਨਿੱਜੀ ਤਜ਼ਰਬਾ ਰਿਹਾ ਕਿ ਲੋਕਾਂ ਨੇ ਉਹਦੇ ਵਿੱਚ ਚਿੜੀਆ ਘਰ ਹਰ ਨਸਲ ਦੇ ਜਿਹੜੇ ਪੰਛੀ ਅਤੇ ਜੀਵ ਜੰਤੂ ਪਾਲੇ ਹੋਏ ਆ ਅਤੇ ਜੇ ਉਹ ਉਹ ਜੀਵ ਜੰਤੂ ਨੇ ਜਿਹੜੇ ਖੇਤੀ ਨੂੰ ਵੀ ਫ਼ਾਇਦਾ ਕਰਦੇ ਹੈਗੇ ਆ ਮਤਲਬ ਕਿ ਉਸ ਕਿਸਮ ਦੀ ਮਤਲਬ ਕਿ ਜਿਹੜੀ ਹੈਗੀ ਆ ਉਹ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਜਿਹੜੇ ਉਹ ਮਤਲਬ ਕਿ ਪ੍ਰੋਡਿਊਸ ਕਰਦੇ ਹੈਗੇ ਉਹ ਖੇਤੀ ਨੂੰ ਬੈਨੀਫ਼ਿਟ ਹੁੰਦਾ ਉਹਦੇ ਵਿੱਚੋਂ ਉਨ੍ਹਾਂ ਨੂੰ ਉੱਥੇ ਪਾਲਣ ਦੇ ਨਾਲ ਤਾਂ ਉਹਦੇ ਵਿੱਚ ਵੀ ਲੋਕ ਉਨ੍ਹਾਂ ਨੂੰ ਦੇਖਣ ਜਾਂਦੇ ਹੈਗੇ ਆ ਤਾਂ ਇਹ ਜਿਹੜੇ ਦੋ ਸੁਝਾਅ ਨੇ ਮੇਰੇ ਧਾਰਮਿਕ ਸਥਾਨ ਅਤੇ ਔਰਗੈਨਿਕ ਫਾਰਮ